ਮੈਂ ਚਾਰ ਮਿੰਟ ਦੇ ਵਿੱਚ ਪੰਜ ਕਿਲੋਮੀਟਰ ਦੌੜ ਲੈਂਦਾ ਹਾਂ ਇਹ ਮੇਰਾ ਸਭ ਤੋਂ ਉੱਚਾ ਰਿਕਾਰਡ ਹੈ ਔਰ ਮੈਂ ਦਿਨ ਦੇ ਵਿੱਚ ਲਗਭਗ ਅੱਠ ਕਿਲੋਮੀਟਰ ਦੌੜਦਾ ਹਾਂ ਸਵੇਰੇ ਚਾਰ ਕਿਲੋਮੀਟਰ ਅਤੇ ਸ਼ਾਮ ਨੂੰ ਚਾਰ ਕਿਲੋਮੀਟਰ ਅਤੇ ਮੇਰਾ ਟੀਚਾ ਹੈ ਕਿ ਮੈਂ ਆਈ ਏ ਐੱਸ ਦੀ ਭਰਤੀ ਦੇਖਣਾ ਚਾਹੁੰਦਾ ਹਾਂ ਜੋ ਕਿ ਹੁਣ ਥੋੜ੍ਹੇ ਹੀ ਸਮੇਂ ਦੇ ਵਿੱਚ ਖੁੱਲ੍ਹਣ ਵਾਲੀਆਂ ਹਨ ਅਤੇ ਇਸ ਦੇ ਲਈ ਹੀ ਮੈਂ ਰੋਜ਼ ਆਪਣੀ ਜੋ ਪਰੈਕਟਿਸ ਨੂੰ ਜਾਰੀ ਰੱਖਦਾ ਹਾਂ